ਸਤਿ ਸ੍ਰੀ ਅਕਾਲ ਜੀ ਮੈਂ ਕੁਝ ਸਮੇਂ ਪਹਿਲੇ ਤੁਹਾਡੇ ਆਨਲਾਈਨ ਵੇਖ ਕੇ ਇੱਕ ਕਰੀਮ ਮੰਗਵਾਈ ਸੀ ਜੋ ਕਿ ਇੱਕ ਫੇਸ ਕਰੀਮ ਸੀ ਮੈਂ ਤੁਹਾਡੇ ਕੋਲੋਂ ਉਹ ਫੇਸ ਕਰੀਮ ਇਸ ਲਈ ਮੰਗਵਾਈ ਸੀ ਕਿਉਂਕਿ ਜਿਵੇਂ ਕਿ ਤੁਸੀਂ ਦੱਸਿਆ ਹੋਇਆ ਸੀ ਐਡ ਵਿੱਚ ਕਿ ਉਹ ਕਰੀਮ ਲਾਉਣ ਨਾਲ ਸਾਡੇ ਚਿਹਰੇ 'ਤੇ ਜਿੰਨੇ ਵੀ ਦਾਗ ਧੱਬੇ ਹਨ ਉਹ ਸਾਰੇ ਮਿਟ ਜਾਣਗੇ ਪਰ ਮੈਂ ਤੁਹਾਨੂੰ ਇਸ ਲਈ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਕਰੀਮ ਦੀ ਵਰਤੋਂ ਕੀਤੀ ਅਤੇ ਮੈਨੂੰ ਉਸ ਨਾਲ ਕੋਈ ਵੀ ਫਰਕ ਨਹੀਂ ਪਿਆ ਬਲਕਿ ਉਸ ਨਾਲ ਮੇਰੇ ਚਿਹਰੇ 'ਤੇ ਹੋਰ ਲਾਲੀ ਛਾ ਗਈ ਉਸ ਲਾਲੀ ਦੀ ਵਜ੍ਹਾ ਨਾਲ ਮੇਰੇ ਚਿਹਰੇ 'ਤੇ ਛੋਟੇ ਛੋਟੇ ਦਾਣੇ ਹੋਣੇ ਸ਼ੁਰੂ ਹੋ ਗਏ ਮੈਨੂੰ ਉਹ ਦੇਖ ਕੇ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੋਈ ਕਿਉਂਕਿ ਇਹ ਮੇਰੇ ਨਾਲ ਇੱਕ ਤਰ੍ਹਾਂ ਦਾ ਫਰੋਡ ਹੋਇਆ ਜੇਕਰ ਕਿਉਂਕਿ ਮੈਂ ਉਸ ਵਾਸਤੇ ਆਪਣੇ ਅੱਠ ਸੌ ਰੁਪਈਆ ਦਾ ਖਰਚਾ ਕੀਤਾ ਸੀ ਜਿਵੇਂ ਕਿ ਤੁਸੀਂ ਕਿਹਾ ਸੀ ਕਿ ਸਾਡੇ ਸਾਰੇ ਫੇਸ 'ਤੇ ਦਾਗ ਧੱਬੇ ਦੂਰ ਹੋ ਜਾਣਗੇ ਪਰ ਦੂਰ ਹੋਣ ਤੋਂ ਇਲਾਵਾ ਉਹ ਦਾਗ ਧੱਬੇ ਮੇਰੇ ਚਿਹਰੇ ਉੱਤੇ ਵੱਧ ਗਏ ਇਸ ਲਈ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਮੇਰੇ ਪੈਸੇ ਵਾਪਿਸ ਭੇਜੋ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਪੈਸਿਆਂ ਦਾ ਭੁਗਤਾਨ ਕਰਾਂ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਕਰੀਮ ਤੁਸੀਂ ਵਾਪਿਸ ਲੈ ਜਾਓ ਅਤੇ ਮੇਰੇ ਪੈਸੇ ਮੈਨੂੰ ਲੋਟਾ ਦੋ ਧੰਨਵਾਦ